ਹੈਲੋ ਭਾਅ ਜੀ ਕੀ ਹਾਲ ਜੇ ਅੱਛਾ ਵਧੀਆ ਚਾਹੀਦਾ ਭਾਅ ਜੀ ਭਾਅ ਜੀ ਤੁਸੀਂ ਲਾਈਟ ਹਾਊਸ ਪਿਜ਼ੇਰੀਆ ਤੋਂ ਬੋਲਦੇ ਪਏ ਜੇ ਹਾਂਜੀ ਹਾਂਜੀ ਹਾਂਜੀ ਭਾਅ ਜੀ ਮੇਰਾ ਨਾ ਇੱਕ ਆਰਡਰ ਹੀ ਤਿੰਨ ਪੀਜ਼ੇ ਮੰਗਵਾਏ ਸੀ ਰੇਸ਼ਮੀ ਪਨੀਰ ਦੋ ਆਪਾਂ ਫਰਾਈਜ਼ ਮੰਗਵਾਏ ਸੀ ਅਤੇ ਨਾਲ ਤਿੰਨ ਬਰਗਰ ਸੀ ਹਾਂਜੀ ਭਾਅ ਜੀ ਹਾਂਜੀ ਹਾਂਜੀ ਉਹ ਮੈਂ ਨਾ ਉਹਦੇ ਨਾਲ ਪੀਣ ਲਈ ਕੋਈ ਸ ਪਦਾਰਥ ਮੰਗਵਾਉਣਾ ਭੁੱਲ ਗਿਆ ਜਿੱਦਾਂ ਕਿ ਜੇ ਲਾ ਲਓ ਕੋਕ ਵਗੈਰਾ ਹੋ ਗਿਆ ਨਾ ਛੇਕ ਹੋ ਗਏ ਮੋਕਟੇਲਸ ਹੋ ਗਈਆਂ ਇਹ ਮੰਗਵਾਉਣਾ ਭੁੱਲ ਗਿਆ ਸੀ ਮੈਂ ਤੁਹਾਡੇ ਕੋਲ ਪੁੱਛਣਾ ਕਿਹੜੇ ਕਿਹੜੇ ਮੋਕਟੇਲ ਹੈਗੇ ਆ ਛੇਕ ਹੈਗੇ ਆ ਅਤੇ ਅ ਕੋਲਡ ਰਿੰਕਸ ਕਿਹੜੀਆਂ ਅਵੇਲੇਬਲ ਹੈਗੀਆਂ ਉੱਥੇ ਉਪਲਬਧ ਹੈਗੀਆਂ ਅੱਛਾ ਨਹੀਂ ਨਹੀਂ ਭਾਅ ਜੀ ਤੁਸੀਂ ਫਿਰ ਇੱਕ ਕੰਮ ਕਰੋ ਤੁਸੀਂ ਨਾ ਦੋ ਕੋਕਟੇਲ ਕਰ ਦਿਓ ਲੈਮਨ ਵਾਲੀਆਂ ਹਾਂਜੀ ਅਤੇ ਇੱਕ ਤੁਸੀਂ ਬਲੈਕ ਰੈਂਡ ਸ਼ੇਕ ਕਰ ਦਿਓ ਹਾਂਜੀ ਤੁਸੀਂ ਇੱਕ ਕਰ ਦਿਓ ਬਬਲਗਮ ਸ਼ੇਕ ਵੀ ਕਰ ਦਿਓ ਨਾਲ ਨਾਲ ਇੱਕ ਮੈਂਗੋ ਵੀ ਕਰ ਦਿਓ ਹਾਂਜੀ ਹਾਂਜੀ ਅਤੇ ਭਾਈ ਕੋਕ ਕਿਹੜੀ ਕਿਹੜੀ ਆਪਣੇ ਕੋਲ ਹੈਗੀ ਆ ਸਪਰਾਈਡ ਲਿਮਕਾ ਫੈਂਟਾ ਨਹੀਂ ਨਹੀਂ ਭਾਅ ਜੀ ਤੁਸੀਂ ਕੰਮ ਕਰੋ ਫਿਰ ਨਾ ਤੁਸੀਂ ਨਾ ਇਕੱਲੀ ਸਪਰਾਈਡ ਕਰ ਦਿਓ ਚਾਰ ਸਪਰਾਈਡ ਕਰ ਦਿਓ ਹਾਂਜੀ ਭਾਅ ਜੀ ਭਾਅ ਜੀ ਮੈਂ ਪੁੱਛਣਾ ਸੀ ਜਿਹੜਾ ਮੈਂ ਪਹਿਲਾਂ ਬਿੱਲ ਸੀ ਉਹ ਤਾਂ ਮੈਂ ਆਨਲਾਈਨ ਪੇ ਕਰ ਦਿੱਤਾ ਵਾ ਅਤੇ ਜਿਹੜਾ ਪੁਰਾਣਾ ਬਿਲ ਜਿਹੜਾ ਨਵਾਂ ਬਿੱਲ ਬਣਿਆ ਵਾ ਇਹਦੇ ਕਿੰਨੇ ਪੈਸੇ ਹੋਏ ਆ ਜਿੰਨੇ ਪੈਸੇ ਹੋਏ ਨਾ ਤੁਸੀਂ ਮੈਨੂੰ ਸੈਂਡ ਕਰ ਦਿਉ ਮੈਂ ਨਾ ਆਨਲਾਈਨ ਇਹ ਵੀ ਪੇ ਕਰ ਦਾਂਗਾ ਅਤੇ ਭਾਅ ਜੀ ਕਿੰਨੀ ਦੇਰ ਤੱਕ ਆਰਡਰ ਪਹੁੰਚੂਗਾ ਭਾਅ ਜੀ ਥੋੜ੍ਹਾ ਜਲਦੀ ਕਰ ਦਿਓ ਡਰੈਸ ਮੈਂ ਤੁਹਾਨੂੰ ਪਾ ਦਿੱਤਾ ਹੈ ਵਾ ਇਹ ਮੇਰਾ ਨੰਬਰ ਹੈਗਾ ਜੇ ਬਾਕੀ ਜੇ ਮੇਰਾ ਐਡਰੈਸ ਨਾ ਲੱਭੇ ਤਾਂ ਮੈਨੂੰ ਫੋਨ ਕਰ ਦਿਓ ਧੰਨਵਾਦ ਭਾਅ ਜੀ ਧੰਨਵਾਦ